ਹਾਂਜੀ ਮੈਂ ਸਿਮਰਨ ਗੱਲ ਕਰ ਰਹੀ ਹਾਂ ਮੈਂ ਸਵਿੱਗੀ ਡੋਟ ਕੌਮ 'ਤੇ ਆਪਣਾ ਔਡਰ ਪਲੇਸ ਕੀਤਾ ਸੀ ਖਾਣ ਵਾਸਤੇ ਜੋ ਕਿ ਮੈਂ ਇੱਕ ਪੀਜ਼ਾ ਔਡਰ ਕੀਤਾ ਸੀਗਾ ਆਪਣਾ ਅਤੇ ਡਿਲੀਵਰੀ ਪਾਰਟਨਰ ਨੇ ਪਹਿਲੇ ਮੇਰਾ ਲੈ ਲਿਆ ਸੀਗਾ ਔਡਰ ਅਤੇ ਜੇ ਮੇਰੇ ਘਰ ਮਹਿਮਾਨ ਆਏ ਸੀ ਅਤੇ ਮੈਂ ਪੀਜ਼ੇ ਔਡਰ ਕੀਤੇ ਸੀ ਅਤੇ ਮੈਂ ਇੱਥੇ ਇਸੀ ਸਹਾਰੇ ਬੈਠੀ ਸੀਗੀ ਕਿ ਹੁਣ ਆਉਂਦਾ ਅਤੇ ਹੁਣ ਆਉਂਦਾ ਲੇਕਿਨ ਐਂਨ ਟਾਈਮ 'ਤੇ ਕੀ ਹੋਇਆ ਕਿ ਡਿਲੀਵਰੀ ਟਾਈਮਿੰਗ ਐਸਟੀਮੇਟ ਦੱਸ ਰਿਹਾ ਸੀ ਮੈਨੂੰ ਤੀਹ ਮਿੰਨਟ ਅਤੇ ਤੀਹ ਦੇ ਕਰਦੇ ਕਰਦੇ ਘੰਟਾ ਹੋ ਗਿਆ ਅਤੇ ਘੰਟੇ ਤੋਂ ਵੀ ਉੱਪਰ ਡੇਢ ਘੰਟਾ ਹੋ ਗਿਆ ਅਤੇ ਉਸ ਤੋਂ ਬਾਅਦ ਮੈਂ ਆਪਣਾ ਔਡਰ ਕੈਂਸਲ ਕਰਤਾ ਅਤੇ ਕੈਂਸਲ ਕਰਨ ਤੋਂ ਬਾਅਦ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਮੈਨੂੰ ਆਪਣੇ ਪੈਸੇ ਵਾਪਸ ਚਾਹੀਦੇ ਹੈ ਮੈਂ ਰਿਫੰਡ ਦਾ ਆਪਣਾ ਰਿਕੁਐਸਟ ਪਾਈ ਹੈ ਮੈਂ ਕੰਪਨੀ ਨਾਲ ਗੱਲ ਵੀ ਕੀਤੀ ਹੈ ਅਤੇ ਮੈਨੂੰ ਕੋਈ ਚੱਜ ਦਾ ਰਿਸਪੋਂਸ ਆਇਆ ਨਹੀਂ ਹੈਗਾ ਇਸ ਕਾਰਨ ਮੈਂ ਤੁਹਾਡੇ ਨਾਲ ਬੇਨਤੀ ਕਰਦੀ ਹਾਂ ਕਿ ਤੁਸੀਂ ਮੇਰਾ ਪੈਸੇ ਰਿਫੰਡ ਕਰ ਦਿਉ ਕਿਉਂਕਿ ਨਾ ਤਾਂ ਮੈਨੂੰ ਚੀਜ਼ ਮਿਲੀ ਵਕਤ ਸਿਰ ਅਤੇ ਦੂਸਰਾ ਤੁਸੀਂ ਕੋਈ ਜਵਾਬ ਵੀ ਨਹੀਂ ਦੇ ਰਹੇ ਅਤੇ ਇਹ ਕੀ ਬਹੁਤ ਇੱਕ ਬੁਰਾ ਇੰਪਰੈਸ਼ਨ ਪੈਂਦਾ ਕੰਪਨੀ ਵੱਲੋਂ ਮੈਂ ਤੁਹਾਡੇ ਤੋਂ ਇੱਕ ਰਿਕੁਐਸਟ ਕਰ ਰਹੀ ਹਾਂ ਕਿ ਤੁਸੀਂ ਮੇਰੇ ਵੋਲਟ 'ਚ ਮੇਰੇ ਪੈਸੇ ਵਾਪਸ ਕਰ ਦਿਉ ਠੀਕ ਹੈ